ਪੰਜਾਬੀ ਵਿੱਚ ਬਹੁਤ ਹੀ ਕਹਾਵਤਾਂ ਅਤੇ ਮੁਹਾਵਰੇ ਹਨ ਪਰ ਮੈਂ ਇੱਕ ਦੱਸਦਾ ਹਾਂ ਘਰ ਦਾ ਨਾ ਘਾਟ ਦਾ ਦੁਸ਼ਮਣ ਅਨਾਜ ਦਾ ਇਹ ਮੁਹਾਵਰਾ ਤਦ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਵੇਹਲਾ ਹੋਵੇ ਅਤੇ ਕੋਈ ਵੀ ਕੰਮ ਨਾ ਕਰੇ ਅਤੇ ਵੇਹਲਾ ਘਰ ਬੈਠ ਕੇ ਰੋਟੀਆਂ ਖਾਵੇ